ਸਾਡੇ ਜ਼ਿਲ੍ਹੇ ਵਿੱਚ ਕਈ ਪੂਜਾ ਸਥਾਨ ਵੀ ਹਨ ਕਈ ਗੁਰਦੁਆਰੇ ਵੀ ਹਨ ਜੋ ਕਿ ਆਪਣੇ ਇਤਿਹਾਸ ਨਾਲ ਜਾਣੇ ਜਾਂਦੇ ਹਨ ਸਭ ਤੋਂ ਵੱਡਾ ਸਥਾਨ ਹਰਿਮੰਦਰ ਸਾਹਿਬ ਹੈ ਜੋ ਕਿ ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ ਉਸਦੇ ਚਾਰ ਦਰਵਾਜ਼ੇ ਹਨ ਜੋ ਕਿ ਉਹਨਾਂ ਦੀ ਨੀਂਹ ਭਾਈ ਵਜ਼ੀਰ ਖਾਂ ਨੇ ਰੱਖੀ ਸੀ ਇਸ ਦਰਬਾਰ ਸਾਹਿਬ ਦੀ ਬਹੁਤ ਜ਼ਿਆਦਾ ਮਹਾਨਤਾ ਹੈ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਮੱਥਾ ਟੇਕਦੇ ਹਨ ਦਰਸ਼ਨ ਕਰਦੇ ਹਨ ਇਸ਼ਨਾਨ ਕਰਦੇ ਹਨ ਦੁੱਖ ਭੰਜਣੀ ਬੇਰੀ ਜੋ ਕਿ ਬਹੁਤ ਜ਼ਿਆਦਾ ਜਾਣੀ ਜਾਂਦੀ ਹੈ ਇੱਥੇ ਦੁੱਖ ਦਰਦ ਕੱਟੇ ਜਾਂਦੇ ਹਨ ਲੋਕ ਆ ਕੇ ਦੂਰੋਂ ਦੂਰੋਂ ਮੱਥਾ ਟੇਕਦੇ ਹਨ ਪ੍ਰਸ਼ਾਦ ਚੜ੍ਹਾਉਂਦੇ ਹਨ ਇੱਥੇ ਕਈ ਤਰ੍ਹਾਂ ਦੇ ਗੁਰਦੁਆਰੇ ਹਨ ਜੋ ਜਿੱਦਾਂ ਦੀ ਮਹਾਨਤਾ ਬਹੁਤ ਜ਼ਿਆਦਾ ਮੰਨੀ ਗਈ ਹੋਈ ਹੈ ਦੂਸਰੀ ਹੈ ਕਿ ਇੱਥੇ ਸ਼ਹੀਦਾਂ ਸਾਹਿਬ ਵੀ ਹੈ ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ ਇਸ 'ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਜਾਣਿਆ ਜਾਂਦਾ ਹੈ ਇਸ ਤੋਂ ਇਸਦੇ ਐਤਵਾਰ ਦੇ ਐਤਵਾਰ ਹਰ ਐਤਵਾਰ ਚੁਪਹਿਰੇ ਲੱਗਦੇ ਹਨ ਲੋਕ ਜੋ ਕਿ ਦੂਰੋਂ ਦੂਰੋਂ ਲੋਕ ਆ ਕੇ ਮੱਥਾ ਟੇਕਦੇ ਹਨ ਆਪਣੇ ਚੁਪਹਿਰੇ ਕੱਟਦੇ ਹਨ ਜੋ ਕਿ ਉਹਨਾਂ ਦੇ ਹਰ ਦੁੱਖ ਦਰਦ ਦੂਰ ਹੁੰਦੇ ਹਨ ਇੱਕ ਇੱਥੇ ਇੱਥੇ ਦੁਰਗਿਆਨਾ ਮੰਦਰ ਵੀ ਹੈ ਜੋ ਕਿ ਬਹੁਤ ਫੇਮਸ ਹੈ ਲੋਕ ਦੂਰੋਂ ਦੂਰੋਂ ਆ ਕੇ ਵੀ ਇੱਥੇ ਆ ਕੇ ਮੱਥੇ ਟੇਕਦੇ ਹਨ ਇਹ ਸਾਰੇ ਜਿਹੜੇ ਗੁਰਦੁਆਰੇ ਹਨ ਸਾਰੇ ਆਪੋ ਆਪਣੇ ਇਤਿਹਾਸ ਦੇ ਨਾਲ ਜਾਣੇ ਜਾਂਦੇ ਹਨ ਅਤੇ ਹਰ ਤਰ੍ਹਾਂ ਦੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਹਨ ਇੱਥੇ ਹਰ ਹਰ ਤਰ੍ਹਾਂ ਹਰ ਤਰ੍ਹਾਂ ਦੇ ਇਨਸਾਨ ਨੂੰ ਇੱਥੇ ਅੰਦਰ ਆਉਣ ਦੀ ਮਹਾਨਤਾ ਦਿੱਤੀ ਜਾਂਦੀ ਹੈ ਮੱਥਾ ਟੇਕਦੇ ਹਨ